ਬਹੁਤ ਸਾਰੇ ਪ੍ਰੋਗਰਾਮ ਹਨ ਜਿੱਥੇ ਅਸੀਂ ਗਾਉਣਾ ਪਸੰਦ ਕਰਦੇ ਹਾਂ ਜਿਵੇਂ ਕਿ ਇੰਸਟਾ ਅੱਜ ਕੱਲ ਦਾ ਸਮਾਂ ਟੈਕਨੋਲੋਜੀ ਦਾ ਦੌਰ ਹੈ ਅਤੇ ਇਸ ਵਿੱਚ ਮੋਬਾਇਲ ਫੋਨ 'ਤੇ ਵੀ ਅਸੀਂ ਜਾਂ ਕਈ ਚੈਨਲ ਮਿਲਦੇ ਹਨ ਜਿਹਨਾਂ 'ਤੇ ਅਸੀਂ ਗਾਉਣਾ ਪਸੰਦ ਕਰ ਸਕਦੇ ਹਾਂ ਜਾਂ ਜਿਹਨਾਂ 'ਤੇ ਗਾਉਣਾ ਪਸੰਦ ਕਰਦੇ ਹਾਂ ਇਸ ਤੋਂ ਇਲਾਵਾ ਇੰਸਟਾਗਰਾਮ ਹੋ ਗਿਆ ਇੰਸਟਾਗਰਾਮ ਅਤੇ ਸਭ ਤੋਂ ਜ਼ਿਆਦਾ ਰੀਲਸ ਬਣਾ ਸਕਦੇ ਹਾਂ ਫੇਸਬੁੱਕ 'ਤੇ ਵੀ ਕਾਫੀ ਜ਼ਿਆਦਾ ਰੀਲਸ ਬਣਾ ਸਕਦੇ ਹਾਂ ਸੋ ਇਹਨਾਂ ਪ੍ਰੋਗਰਾਮਾਂ ਵਿੱਚ ਅਸੀਂ ਗਾਉਣਾ ਬਹੁਤ ਪਸੰਦ ਕਰਦੇ ਹਾਂ